ਮੇਰਾ ਮਨਪਸੰਦ ਭੋਜਨ ਜਿਹੜਾ ਹੈ ਸਾਊਥ ਇੰਡੀਅਨ ਭੋਜਨ ਹੈ ਔਰ ਕਿਉਂਕਿ ਉਹ ਹੈਲਦੀ ਹੁੰਦਾ ਹੈ ਉਹ ਮੈਦਾ ਨਹੀਂ ਹੁੰਦਾ ਉਸ ਵਿੱਚ ਅਤੇ ਜ਼ਿਆਦਾਤਰ ਜਿਹੜਾ ਸੂਜੀ ਜਾਂ ਚਾਵਲਾਂ ਦੇ ਰੀਲੇਟਿਡ ਉਹਦੀਆਂ ਸਾਰੀ ਚੀਜ਼ਾਂ ਹੁੰਦੀਆਂ ਜਿਹੜੀਆਂ ਬਣੀਆਂ ਹੁੰਦੀਆਂ ਸਾਰਾ ਹੈਲਦੀ ਹੁੰਦਾ ਇਸ ਕਰਕੇ ਪਸੰਦ ਹੈ